ਮੈਂ ਰਾਜ ਕੁਮਾਰ ਡਿਸਟ੍ਰਿਕਟ ਗੁਰਦਾਸਪੁਰ ਜ਼ਿਲ੍ਹੇ ਦਾ ਰਹਿਣ ਵਾਲਾ ਹਾਂ ਜਿਵੇਂ ਕਿ ਸਾਡੇ ਖੇਤਰ ਵਿੱਚ ਇੰਡਸਟਰੀ ਵੀ ਲੱਗ ਸਕਦੀ ਹੈ ਜਿਵੇਂ ਕਿ ਕੋਕੋ ਕੋਲਾ ਦੀ ਫੈਕਟਰੀ ਜਾਂ ਗੱਤੇ ਦੀ ਫੈਕਟਰੀ ਜਾਂ ਸ਼ੂਗਰ ਮਿੱਲ ਜਾਂ ਆਪਣੇ ਕਿਆ ਬੋਲਦੇ ਆਈਸਕ੍ਰੀਮ ਫੈਕਟਰੀ ਕੁਛ ਵੀ ਕਰ ਸਕਦੇ